ਹਰ ਇੱਕ ਨੂੰ ਆਪਣੇ ਘਰ ਵਿੱਚ ਬਾਗਬਾਨੀ ਕਰਨ ਦਾ ਸ਼ੌਕ ਹੁੰਦਾ ਹੈ ਅਤੇ ਮੈਨੂੰ ਵੀ ਆਪਣੇ ਘਰ ਵਿੱਚ ਫਲ ਅਤੇ ਸਬਜ਼ੀਆਂ ਉਗਾਉਣ ਦਾ ਬਹੁਤ ਸ਼ੌਕ ਹੈ ਅਤੇ ਮੈਂ ਇਹ ਛੋਟੇ ਮੋਟਾ ਫਲ ਸਬਜ਼ੀਆਂ ਅੰਗੋ ਉਗਾਉਂਦੀ ਹੀ ਰਹਿੰਦੀ ਹਾਂ ਅਤੇ ਫਲ ਜੋ ਕੋਸ਼ਿਸ਼ ਕਰੀ ਦੀ ਹੈ ਉਗਾਉਣ ਦੀ ਪਰ ਬਹੁਤ ਦੇਰ ਬਾਅਦ ਨਾ ਫਲ ਆਉਂਦਾ ਤਾਂ ਕਈ ਵਾਰ ਮਨ 'ਚ ਨੀਰਸਤਾ ਵੀ ਮਹਿਸੂਸ ਹੁੰਦੀ ਹੈ ਕਿ ਕਦੋਂ ਦੀ ਇਹਦੀ ਸੇਵਾ ਕਰਦੇ ਹਾਂ ਬੂਟੇ ਦੀ ਅਤੇ ਇਹਦੇ ਫਲ ਹੀ ਨਹੀਂ ਆਉਂਦਾ ਅਤੇ ਸਬਜ਼ੀਆਂ ਉਗਾਉਣ ਦਾ ਮੈਨੂੰ ਕਾਫੀ ਸ਼ੌਂਕ ਆ ਕਿਉਂਕਿ ਇਹ ਜਲਦੀ ਫਲ ਦੇ ਦਿੰਦੀਆਂ ਅਤੇ ਸਬਜ਼ੀਆਂ ਬਣਾ ਲਈ ਦੀਆਂ ਨਾ ਇੱਕ ਔਰਗੈਨਿਕ ਤਰੀਕੇ ਦੇ ਨਾਲ ਸਬਜ਼ੀਆਂ ਉਗਾਉਣ ਦੇ ਨਾਲ ਸਰੀਰ ਨੂੰ ਬੜੇ ਫਾਇਦੇ ਹੁੰਦੇ ਹਨ ਅਤੇ ਖਾਦ ਤੋਂ ਮੁਕਤ ਘਰ 'ਚ ਬਾਗਬਾਨੀ ਕੀਤੀ ਜਾਂਦੀ ਹੈ ਸਬਜ਼ੀਆਂ ਦੀ ਅਤੇ ਜਿਹੜੀਆਂ ਸਿਹਤ ਵਾਸਤੇ ਵੀ ਚੰਗੀਆਂ ਹੁੰਦੀਆਂ ਹਨ ਅਗਰ ਘਰ ਇਹ ਅਸੀਂ ਫਲ ਸਬਜ਼ੀਆਂ ਉਗਾਈਏ ਤਾਂ ਬਹੁਤ ਚੰਗਾ ਰਹਿੰਦਾ ਹੈ ਮੈਂ ਵੀ ਕੋਸ਼ਿਸ਼ ਕਰਦੀ ਹਾਂ ਅਤੇ ਕਾਫੀ ਚੰਗਾ ਅਨੁਭਵ ਰਿਹਾ ਹੈ ਕਿ ਅਸੀਂ ਆਪਣੇ ਇੱਕ ਤਾਂ ਫਰੀ ਟਾਈਮ ਨੂੰ ਚੰਗੀ ਤਰ੍ਹਾਂ ਪ੍ਰਯੋਗ ਕਰ ਸਕਦੇ ਹਾਂ ਅਤੇ ਇੱਕ ਨੇਚਰ ਨੂੰ ਉਹ ਸਵੱਛ ਰੱਖਣ ਦੀ ਵੀ ਇਹ 'ਚ ਵੀ ਮਦਦ ਕਰ ਸਕਦੇ ਹਾਂ ਅਤੇ ਆਸ ਪਾਸ ਦਾ ਵਾਤਾਵਰਨ ਵੀ ਸਾਡਾ ਸਾਫ਼ ਰਹਿ ਸਕਦਾ ਹੈ ਅਤੇ ਅਗਰ ਖੁਦ ਅਸੀਂ ਫਲ ਸਬਜ਼ੀਆਂ ਖੁਦ ਉਗਾਵਾਂਗੇ ਤਾਂ ਸਾਡੀ ਸਿਹਤ ਵੀ ਚੰਗੀ ਰਹੂਗੀ ਅਤੇ ਜੋ ਮੈਂ ਕੋਸ਼ਿਸ਼ ਕੀਤੀ ਫਲ ਅਤੇ ਸਬਜ਼ੀਆਂ ਉਗਾਉਣ ਦੀ ਤਾਂ ਬਹੁਤ ਚੰਗਾ ਮੇਰਾ ਅਨੁਭਵ ਰਿਹਾ ਮੈਂ ਇੱਕ ਔਰਗੈਨਿਕ ਤਰੀਕੇ ਦੇ ਨਾਲ ਆਪਣੀ ਛੱਤ 'ਤੇ ਬਿਲਕੁਲ ਬਣਾ ਕੇ ਪਲੇਨ ਏਰੀਆ ਗਮਲਿਆਂ ਦੇ ਵਿੱਚ ਵੀ ਕਈ ਤਰੀਕੇ ਦੇ ਮੈਂ ਸਬਜ਼ੀਆਂ ਛੋਟੀਆਂ ਮੋਟੀਆਂ ਪੁਦੀਨਾ ਵਗੈਰਾ ਅਤੇ ਧਨੀਆ ਵਗੈਰਾ ਉਗਾਇਆ ਅਤੇ ਮੂਲੀਆਂ ਵਗੈਰਾ ਉਗਾਈਆਂ ਅਤੇ ਮੈਨੂੰ ਬਹੁਤ ਚੰਗਾ ਲੱਗਾ ਅਤੇ ਹੌਲੀ ਹੌਲੀ ਮੇਰੀ ਰੁਚੀ ਏ ਵਧਦੀ ਗਈ ਅਤੇ ਮੈਂ ਥੋੜ੍ਹੀ ਥੋੜ੍ਹੀ ਜ਼ਿਆਦਾ ਵਧਾਉਂਦੀ ਗਈ ਆਪਣਾ ਫਲ ਸਬਜ਼ੀਆਂ ਉਗਾਉਣ ਦਾ ਪ੍ਰੋਸੀਜ਼ਰ ਜ਼ਿਆਦਾਤਰ ਤਾਂ ਮੈਂ ਸਬਜ਼ੀਆਂ ਉਗਾਉਣਾ ਹੀ ਪਸੰਦ ਕਰਦੀ ਹਾਂ ਕਿਉਂਕਿ ਤੁਹਾਨੂੰ ਇੱਕ ਥੋੜ੍ਹੀ ਜਗ੍ਹਾ ਹੋਣ ਦੇ ਕਰਕੇ ਗਮਲੇ ਵਗੈਰਾ ਯੂਜ਼ ਪ੍ਰਯੋਗ ਕਰਕੇ ਅਤੇ ਸਬਜ਼ੀਆਂ ਉਗਾਉਣ ਦੀ ਕੋਸ਼ਿਸ਼ ਕਰਦੀ ਹਾਂ ਅਤੇ ਬਹੁਤ ਚੰਗਾ ਅਨੁਭਵ ਹੈ ਅਤੇ ਇੱਕ ਸਮੇਂ ਨੂੰ ਪ੍ਰਯੋਗ ਕਰਨ ਦਾ ਇੱਕ ਚੰਗਾ ਮੌਕਾ ਹੁੰਦਾ ਹੈ